ਮੈਂ ਸਭ ਤੋਂ ਪਹਿਲਾਂ ਰਾਜਸਥਾਨ ਵਿੱਚ ਤਸਵੀਰ ਲੈਤੀ ਸੀ ਅਤੇ ਉਦੋਂ ਮੇਰੀ ਉਮਰ ਪੰਜ ਤੋਂ ਛੇ ਸਾਲ ਦੇ ਵਿੱਚ ਵਿੱਚ ਸੀ ਉਦੋਂ ਤਸਵੀਰ ਮੇਰੇ ਮਾਮੇ ਨੇ ਆਪਣੇ ਕੈਮਰੇ ਤੋਂ ਖਿੱਚੀ ਸੀ ਉਦੋਂ ਕੈਮਰਾ ਹੋਣਾ ਬਹੁਤ ਹੀ ਵੱਡੀ ਗੱਲ ਹੁੰਦੀ ਸੀ ਅਤੇ ਉਹ ਤਸਵੀਰ ਬਹੁਤ ਹੀ ਸੁੰਦਰ ਅਤੇ ਸਿਨਮੈਟਿਕ ਆਈ ਸੀ ਉਹ ਤਸਵੀਰ ਦੀ ਇਹ ਮਹੱਤਤਾ ਸੀ ਕਿ ਮੈਂ ਪਹਿਲੀ ਵਾਰੀ ਤਾਂ ਕਿਤੇ ਬਾਹਰ ਘੁੰਮਣ ਗਿਆ ਸੀ ਪੰਜਾਬ ਤੋਂ ਬਾਅਦ ਅਤੇ ਗਿਆ ਵੀ ਆਪਦੀ ਫੇਵਰੇਟ ਜਗ੍ਹਾ 'ਤੇ ਸੀ ਰਾਜਸਥਾਨ ਰਾਜਸਥਾਨ ਮੈਨੂੰ ਤਾਂ ਕਰਕੇ ਵਧੀਆ ਲੱਗਦਾ ਹੈ ਕਿਉਂਕਿ ਉਸ ਦਾ ਇੱਕ ਅੱਡ ਹੀ ਇਤਿਹਾਸ ਹੈ ਜਿਵੇਂ ਕਿ ਪੁਰਾਣੀ ਕਿਲੇ ਲੇਕਸ ਅਤੇ ਹੋਰ ਵੀ ਕਈ ਚੀਜ਼ਾਂ ਕਿਲਿਆਂ 'ਚ ਜਾ ਕੇ ਤਾਂ ਮੱਲੋ ਮੱਲੀ ਹੀ ਜਿਸ ਬੰਦੇ ਦਾ ਦਿਲ ਨਹੀਂ ਲੱਗਦਾ ਉੱਥੇ ਦਿਲ ਲੱਗਣ ਲੱਗ ਜਾਂਦਾ ਹੈ ਅੱਧੇ ਤਾਂ ਕਿਸੇ ਰਾਣੀ ਦੀ ਯਾਦ 'ਚ ਕਈ ਕਿਸੇ ਹੋਰ ਕਿਸੇ ਯਾਦ 'ਚ ਕਈ ਤਾਂ ਕਿਸੇ ਦੇ ਮਰਨ ਤੱਕ ਵੀ ਬਣਾਏ ਗਏ ਹਨ ਉੱਥੇ ਜੇਕਰ ਸਾਨੂੰ ਕੋਈ ਟੂਰ ਲੈ ਕੇ ਜਾਂਦਾ ਹੈ ਤਾਂ ਸਾਨੂੰ ਮਨ੍ਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਉੱਥੇ ਜੇਕਰ ਅਸੀਂ ਜਾਨੇ ਹਾਂ ਤਾਂ ਸਾਡਾ ਮਾਇੰਡ ਹੀ ਫਰੈਸ਼ ਹੁੰਦਾ ਹੈ ਅਤੇ ਜੋ ਰਾਹ ਵਿੱਚ ਜਾਂਦਿਆਂ ਨੂੰ ਨਜ਼ਾਰੇ ਦਿਖਦੇ ਹਨ ਰੇਤੀਲੇ ਪਹਾੜ ਦਿਖਦੇ ਨੇ ਅਤੇ ਰੇਤ ਵਿੱਚ ਖੇਡਦੇ ਹਾਂ ਉਸ ਨਾਲ ਸਾਡਾ ਬਚਪਨ ਸਾਨੂੰ ਫਿਰ ਤੋਂ ਭਾਉਂਦਾ ਹੈ ਵੀ ਅਸੀਂ ਫਿਰ ਤੋਂ ਖੇਡੀਏ